ਮੈਂ ਜਿਸ ਟਾਈਮ ਦਸਵੀਂ ਕਲਾਸ ਪੇਪਰ ਦਿੱਤੇ ਸੀ ਉਸ ਟਾਈਮ ਤੇ ਮੈਂ ਕੁਕਿੰਗ ਕਲਾਸਾਂ ਜੁਆਇਨ ਕੀਤੀਆਂ ਸੀ ਭੱਲਾ ਕੁਕਿੰਗ ਸੈਂਟਰ ਜਲੰਧਰ ਤੋਂ ਜਿੱਥੇ ਕਿ ਮੈਂ ਉਸ ਟਾਈਮ 'ਤੇ ਵੈਜ ਨੋਨ ਵੈਜ ਦੋਨੋਂ ਤਰ੍ਹਾਂ ਦੀਆਂ ਚੀਜ਼ਾਂ ਸਿੱਖੀਆਂ ਸੀ ਪੰਜਾਬੀ ਅਤੇ ਸਾਊਥ ਇੰਡੀਅਨ ਦੋਨੋਂ ਸਿੱਖੇ ਸੀ ਔਰ ਉਹ ਵਰਕਸ਼ਾਪ ਦੇ ਵਿੱਚ ਆਪਾਂ ਜ਼ਿਆਦਾਤਰ ਆਪਣੇ ਘਰਾਂ ਦੇ ਵਿੱਚ ਆਪਾਂ ਆਪਣੇ ਮਾਵਾਂ ਆਪਣੀਆਂ ਦਾਦੀਆਂ ਜਾਂ ਸਾਰਿਆਂ ਤੋਂ ਵੱਡਿਆਂ ਤੋਂ ਕੁਛ ਨਾ ਕੁਛ ਸਿੱਖਦੇ ਹਾਂ ਪਰ ਉਹ ਇੱਕ ਨਾਪਤੋਲ ਤੋਂ ਬਿਨਾਂ ਹੁੰਦਾ ਔਰ ਉਹ ਐਕਸਪੀਰੀਅੰਸ ਵੱਖਰਾ ਹੁੰਦਾ ਪਰ ਜਿਹੜਾ ਅਸੀਂ ਵਰਕਸ਼ਾਪ ਵਗੈਰਾ 'ਤੇ ਜਾਂ ਜਿਹੜੀਆਂ ਕੁਕਿੰਗ ਕਲਾਸਿਸ ਲਗਾਉਂਦੇ ਹਾਂ ਉਹਨਾਂ ਦੇ ਵਿੱਚ ਜੋ ਅਸੀਂ ਸਿੱਖਦੇ ਹਾਂ ਉਹਦੇ ਵਿੱਚ ਹਰ ਚੀਜ਼ ਨੂੰ ਇੱਕ ਨਾਪਤੋਲ ਦੇ ਨਾਲ ਬਣਾਇਆ ਜਾਂਦਾ ਉਹ ਇੱਕ ਅਲੱਗ ਤਰ੍ਹਾਂ ਦੀ ਜਾਣਕਾਰੀ ਹਾਸਿਲ ਕਰਨਾ ਹੁੰਦਾ ਮੇਰੀ ਜਿਹੜੀ ਵਰਕਸ਼ਾਪ ਰਹੀ ਸੀ ਉਹ ਬਹੁਤ ਹੀ ਵਧੀਆ ਰਹੀ ਸੀ ਜੇ ਹੁਣ ਵੀ ਜੇ ਦੁਬਾਰਾ ਕਦੇ ਵਰਕਸ਼ਾਪ ਲੱਗਦੀ ਹੈ ਤਾਂ ਮੈਂ ਚਾਹਵਾਂਗੀ ਕਿ ਮੈਂ ਅੱਗੋਂ ਵੀ ਜਿਹੜੇ ਖਾਣੇ ਮੈਂ ਚਾਈਨੀਜ਼ ਵਗੈਰਾ ਨਹੀਂ ਬਣਾਏ ਮੈਂ ਉਹ ਵੀ ਬਣਾ ਕੇ ਉਹਨਾਂ ਨੂੰ ਵੀ ਸਿੱਖਣਾ ਚਾਹਾਂਗੀ